ਹੈਲੋ ਸਤਿ ਸ਼੍ਰੀ ਅਕਾਲ ਜੀ ਭੰਗੜੇ ਦੇ ਕੁਝ ਆਮ ਸਟੈਪਾਂ ਦੇ ਨਾਮ ਸਿੰਗਲ ਜੱਫਾ ਡਬਲ ਜੱਫਾ ਡੀਟੇਨ ਥੜੀ ਖੜ੍ਹਾ ਥੜੀ ਲੁੱਡੀ ਇਹ ਸਭ ਜੀ ਭੰਗੜੇ ਦੇ ਸਟੈਪਾਂ ਦੇ ਨਾਮ ਆ ਪੰਜਾਬੀ ਸੱਭਿਆਚਾਰ ਆਪਣਾ ਜਿਹਨੂੰ ਕਹਿੰਦੇ ਆ ਇਨਕਰੈਡਿਬਲੇ ਕਲ ਕਲਚਰ ਆ ਆਪਣਾ ਜਿਹਨੂੰ ਕਹਿ ਦਿੰਦੇ ਹਾਂ ਬਹੁਤ ਹੀ ਵਧੀਆ ਕਲਚਰ ਪਾਇਆ ਜਾਂਦਾ ਪੰਜਾਬ ਦਾ ਹਾਂਜੀ ਅਤੇ ਪੰਜਾਬ ਦੇ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਪੰ ਪੰਜਾਬੀਆਂ ਦੀ ਤਾਂ ਸ਼ਾਨ ਹੀ ਵੱਖਰੀ ਆ ਹਾਂਜੀ ਅਤੇ ਆਪਣੇ ਪੰਜਾਬੀਆਂ ਨੇ ਬਾਹਰਲੇ ਪਰਦੇਸ਼ਾਂ ਦੇ ਵਿੱਚ ਵੀ ਭੰਗੜੇ ਨੂੰ ਬਹੁਤ ਹੀ ਜ਼ਿਆਦਾ ਮਸ਼ਹੂਰ ਕੀਤਾ ਜਿੱਦਾਂ ਕੈਨੇਡਾ ਲੈ ਲਓ ਅਮੈਰੀਕਾ ਲੈ ਲਓ ਹਰ ਇੱਕ ਦੇਸ਼ ਦੇ ਵਿੱਚ ਭੰਗੜਾ ਅੱਜ ਕੱਲ੍ਹ ਹਰ ਇੱਕ ਕਿਤੇ ਵੀ ਚਲ ਜਾਵੇ ਕਾਲਜ ਸਕੂਲ ਦੇ ਵਿੱਚ ਵੀ ਵਿਖਾਇਆ ਜਾਂਦਾ ਹੈ ਅਤੇ ਜਦੋਂ ਮੈਂ ਵੀ ਆਪਣੇ ਕਾਲਜ ਟਾਈਮ 'ਤੇ ਸੀਗਾ ਅਤੇ ਮੈਂ ਵੀ ਭੰਗੜਾ ਬਹੁਤ ਹੀ ਚਾਹਤ ਦੇ ਨਾਲ ਉੱਥੇ ਕਰਦਾ ਸੀਗਾ ਮੈਂ ਵੀ ਮੈਨੂੰ ਲੱਗਦਾ ਕਿ ਮੈਂ ਸੱਤ ਅੱਠ ਵਾਰੀ ਕਾਲਜ ਦੇ ਵਿੱਚ ਭੰਗੜਾ ਕੀਤਾ ਥਰਡ ਕਲਾਸ ਤੋਂ ਲੈ ਕੇ ਪਲਸ ਟੂ ਦੇ ਤੱਕ ਮੈਂ ਭੰਗੜਾ ਕਰਦਾ ਰਿਹਾ ਹਾਂ ਆਪਣਾ ਤਾਂ ਪੰਜਾਬੀਆਂ ਦਾ ਤੁਹਾਨੂੰ ਪਤਾ ਹੀ ਈ ਕਿ ਵੈਸੇ ਵੀ ਐਨਰਜੀ ਬਹੁਤ ਹੁੰਦੀ ਆ ਖੂਨ ਦੇ ਵਿੱਚ ਗਰਮ ਖੂਨ ਹੁੰਦਾ ਅਤੇ ਜਸ਼ਨ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਂਦੇ ਹਾਂ ਸੁਭਾਅ ਵੀ ਆਪਣਾ ਜੋਲੀ ਨੇਚਰ ਦੇ ਪਾਏ ਜਾਂਦੇ ਹਾਂ ਮੈਂ ਤਾਂ ਵੈਸੇ ਵੀ ਭੰਗੜੇ ਦੇ ਵਿੱਚ ਹੀ ਭੰਗੜੇ ਨੂੰ ਸਾਡਾ ਕਲਚਰ ਵੀ ਆ ਅਤੇ ਮੈਂ ਤਾਂ ਭੰਗੜੇ ਦੇ ਵਿੱਚ ਯੋਗਦਾਨ ਮੈਂ ਤਾਂ ਕਹਿੰਦਾ ਹਰ ਇੱਕ ਬੱਚੇ ਨੂੰ ਪਾਉਣਾ ਚਾਹੀਦਾ ਆ